ਵੈਸੇ ਤਾਂ ਅੰਗਰੇਜ਼ਾਂ ਦੁਆਰਾ ਚਾਹ ਨੂੰ ਭਾਰਤ ਵਿੱਚ ਲਿਆਇਆ ਗਿਆ ਸੀ ਪਰ ਦੁਨੀਆਂ ਭਰ ਵਿੱਚ ਲੋਕ ਹਜ਼ਾਰਾਂ ਸਦੀਆਂ ਤੋਂ ਚਾਹ ਪੀਂਦੇ ਆ ਰਹੇ ਹਨ ਇਹਦੇ ਚੰਗੇ ਕਾਰਨ ਵੀ ਨੇ ਪਰ ਜਦੋਂ ਕਿਸੇ ਚੀਜ਼ ਦੀ ਮਾਤਰਾ ਨੂੰ ਜ਼ਿਆਦਾ ਮਾਤਰਾ ਵਿੱਚ ਲਿਆ ਜਾਂਦਾ ਤਾਂ ਉਹਦੇ ਨੁਕਸਾਨ ਵੀ ਨੇ ਚਾਹ ਦੇ ਬਹੁਤ ਸਾਰੇ ਫਾਇਦੇ ਹਨ ਜਿਵੇਂ ਕਿ ਚਾਹ ਸਾਡੇ ਬਲੱਡ ਪ੍ਰੈਸ਼ਰ ਕੋਲੈਸਟਰੋਲ ਸਟਰੈਸ ਲੈਵਲ ਮੈਂਟਲ ਹੈਲਥ ਵਿੱਚ ਫਾਇਦੇਮੰਦ ਹੈ ਭਾਰਤ ਦੇ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਚਾਹ ਮਿਲ ਦੇਖਣ ਨੂੰ ਮਿਲਦੀਆਂ ਹਨ ਜਿਵੇਂ ਕਿ ਮਸਾਲਾ ਚਾਹ ਜਿਹਦੇ ਵਿੱਚ ਚਾਹ ਦੇ ਵਿੱਚ ਚਾਹ ਪੱਤੀ ਦੇ ਨਾਲ ਨਾਲ ਮਸਾਲੇ ਦਾ ਵੀ ਉਪਯੋਗ ਕੀਤਾ ਜਾਂਦਾ ਹੈ ਉਸੇ ਤਰ੍ਹਾਂ ਹੀ ਬਲੈਕ ਚਾਹ ਜਿਹਦੇ ਵਿੱਚ ਸਿਰਫ ਚਾਹ ਨੂੰ ਹੀ ਉਬਾਲਿਆ ਜਾਂਦਾ ਹੈ ਅਤੇ ਉਹਦੇ ਵਿੱਚ ਦੁੱਧ ਦਾ ਉਪਯੋਗ ਨਹੀਂ ਕੀਤਾ ਜਾਂਦਾ ਉਸੇ ਤਰ੍ਹਾਂ ਹੀ ਗਰੀਨ ਚਾਹ ਆ ਗਈ ਜਿਹਦੇ ਵਿੱਚ ਚਾਹ ਦੀਆਂ ਪੱਤੀਆਂ ਨੂੰ ਹੀ ਪਾਣੀ ਦੇ ਵਿੱਚ ਉਬਾਲਿਆ ਜਾਂਦਾ ਹੈ ਉਸੇ ਤਰ੍ਹਾਂ ਪੀਲੀ ਚਾਹ ਜਿਹਦੇ ਵਿੱਚ ਪਾਣੀ ਵਿੱਚ ਕੇਸਰ ਨੂੰ ਉਬਾਲ ਕੇ ਪੀਤਾ ਜਾਂਦਾ ਹੈ ਉਸੇ ਤਰ੍ਹਾਂ ਹੀ ਅੱਜ ਕੱਲ੍ਹ ਬਹੁਤ ਜ਼ਿਆਦਾ ਪ੍ਰਚੱਲਿਤ ਹੈ ਕੁੱਲੜ ਚਾਹ ਜਿਹਦੇ ਵਿੱਚ ਮਿੱਟੀ ਦੇ ਭਾਂਡੇ ਵਿੱਚ ਚਾਹ ਨੂੰ ਬਣਾਇਆ ਜਾਂਦਾ ਹੈ ਉਹ ਮਿੱਟੀ ਦੇ ਚੰਗੇ ਜਿਹੜੇ ਉਪਯੋਗ ਹੈ ਮਿੱਟੀ ਦੇ ਚੰਗੇ ਗੁਣ ਨੇ ਉਹ ਚਾਹ ਦੇ ਵਿੱਚ ਆ ਜਾਂਦੇ ਹਨ ਅਤੇ ਇਹ ਹੋਰ ਜ਼ਿਆਦਾ ਫਾਇਦੇਮੰਦ ਹੋ ਜਾਂਦੀ ਹੈ ਜੇਕਰ ਮੈਂ ਗੱਲ ਕਰਾਂ ਮੇਰੇ ਘਰ ਦੇ ਵਿੱਚ ਚਾਹ ਬਣਾਉਣ ਲਈ ਸਪੈਸ਼ਲ ਮਸਾਲਾ ਬਣਾਇਆ ਜਾਂਦਾ ਹੈ ਸਾਡੇ ਘਰ ਦੇ ਵਿੱਚ ਸਪੈਸ਼ਲ ਮਸਾਲਾ ਚਾਹ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਅਤੇ ਜਿਹੜਾ ਸਪੈਸ਼ਲ ਮਸਾਲਾ ਬਣਾਇਆ ਜਾਂਦਾ ਏ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਯੂਜ਼ ਹੁੰਦੀਆਂ ਨੇ ਜਿਵੇਂ ਕਿ ਸੌਂਫ ਇਲਾਇਚੀ ਛੋਟੀ ਇਲਾਇਚੀ ਵੱਡੀ ਇਲਾਇਚੀ ਦਾਲਚੀਨੀ ਲੌਂਗ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਮਿਲਾ ਕੇ ਮਸਾਲਾ ਬਣਾਇਆ ਜਾਂਦਾ ਹੈ ਅਤੇ ਪਾਣੀ ਦੇ ਵਿੱਚ ਪਹਿਲੇ ਮਸਾਲੇ ਨੂੰ ਉਬਾਲਿਆ ਜਾਂਦਾ ਹੈ ਫਿਰ ਉਹ ਤੋਂ ਬਾਅਦ ਚਾਹ ਪੱਤੀ ਪਾਈ ਜਾਂਦੀ ਹੈ ਅਤੇ ਫਿਰ ਉਹ ਤੋਂ ਬਾਅਦ ਦੁੱਧ ਅਤੇ ਚੀਨੀ ਮਿਲਾਈ ਜਾਂਦੀ ਹੈ